ਜਦੋਂ ਵੀ ਕਿਸੇ ਕੰਮ ਵਾਲੀ ਥਾਂ ਤੇ ਮੈਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸਭ ਤੋਂ ਪਹਿਲਾਂ ਮੈਂ ਸਹਿਜਤਾ ਨਾਲ ਉਸ ਮੁਸੀਬਤ ਬਾਰੇ ਸੋਚਦੀ ਹਾਂ ਅਤੇ ਉਸ ਨੂੰ ਸੋਚਣ ਤੋਂ ਬਾਅਦ ਮੈਨੂੰ ਕੋਈ ਨਾ ਕੋਈ ਹੱਲ ਜ਼ਰੂਰ ਮਿਲਦਾ ਹੈ ਅਗਰ ਫਿਰ ਵੀ ਮੈਨੂੰ ਕੋਈ ਰਸਤਾ ਨਹੀਂ ਦਿਖ ਰਿਹਾ ਤਾਂ ਮੈਂ ਆਪਣੇ ਤੋਂ ਵੱਡਿਆਂ ਨਾਲ ਉਸ ਸਮੱਸਿਆ ਬਾਰੇ ਡਿਸਕਸ ਕਰਦੀ ਹਾਂ ਅਤੇ ਫਿਰ ਅਸੀਂ ਇਕੱਠੇ ਮਿਲ ਕੇ ਉਸ ਮੁਸੀਬਤ ਦਾ ਹੱਲ ਲੱਭਦੇ ਹਾਂ ਜਿਵੇਂ ਕਿ ਪੰਜਾਬੀ ਦੇ ਵਿੱਚ ਮਸ਼ਹੂਰ ਕਹਾਵਤ ਹੈ ਕਿ ਏਕਤਾ ਵਿੱਚ ਬਲ਼ ਹੈ ਅਤੇ ਜਦੋਂ ਅਸੀਂ ਆਪਸ ਦੇ ਵਿੱਚ ਰਲ਼ ਕੇ ਕੁਝ ਸਮੱਸਿਆ ਦਾ ਹੱਲ ਲੱਭਦੇ ਹਾਂ ਤਾਂ ਅਸੀਂ ਜ਼ਰੂਰ ਕਾਮਯਾਬ ਹੁੰਦੇ ਹਾਂ